ਮੇਰੇ ਕੋਲ ਵੱਖ ਵੱਖ ਤਰੀਕੇ ਦੇ ਜੁੱਤੇ ਹਨ ਜੋ ਕੀ ਮੈਂ ਅਲੱਗ ਅਲੱਗ ਸਮੇਂ ਤੇ ਉਨ੍ਹਾਂ ਦੀ ਜਰੂਰਤਾਂ ਮੁਤਾਬਕ ਪਾਉਣਾ ਹਾਂ ਜਿਵੇਂ ਕੀ ਸਵੇਰੇ ਰਨਿੰਗ 'ਤੇ ਜਾਣ ਲੱਗੇ ਮੈਂ ਰਨਿੰਗ ਆਲੇ ਜੁੱਤੇ ਪਾਉਂਦਾ ਹਾਂ ਫੇਰ ਜੇਕਰ ਮੈਂ ਜੀਨ ਪਾਈ ਹੈ ਤਾਂ ਮੈਂ ਕੋਈ ਸਨੀਕਰ ਪਾ ਲੈਨਾ ਹਾਂ ਜੇ ਮੈਂ ਫੋਰਮਲ ਕੱਪੜੇ ਪਾਏ ਹੈ ਤਾਂ ਮੈਂ ਫੋਰਮਲ ਜੁੱਤੇ ਪਾਉਂਦਾ ਹਾਂ ਜਦੋਂ ਮੈਂ ਕੋਈ ਖੇਡ ਖੇਡਣ ਜਾਂਦਾ ਹਾਂ ਤਾਂ ਮੈਂ ਉਸ ਦਾ ਪਹਿਨਾਵਾ ਪਹਿਲਾਂ ਤੋਂ ਤਿਆਰ ਰੱਖਦਾ ਹਾਂ ਜਿਵੇਂ ਕੀ ਕ੍ਰਿਕਟ ਖੇਡਣ ਸਮੇਂ ਮੇਰੇ ਕੋਲ ਇੱਕ ਲੋਅਰ ਟੀ ਸ਼ਰਟ ਅਤੇ ਕ੍ਰਿਕਟ ਆਲੇ ਜੁੱਤੇ ਹੈਗੇ ਨੇ ਜਿਸ ਵਿੱਚ ਮੈਂ ਇਹ ਖੇਡ ਅਰਾਮਦਾਇਕ ਨਾਲ ਖੇਡ ਸਕਦਾ ਹਾਂ ਪਰ ਕਦੇ ਕਦੇ ਮੇਰੇ ਕੋਲ ਇਹ ਕੱਪੜੇ ਧੋਤੇ ਹੋਏ ਨਈਂ ਹੁੰਦੇ ਤਾਂ ਮੈਂ ਕੋਈ ਵੀ ਨੋਰਮਲ ਕੱਪੜੇ ਪਾ ਕੇ ਖੇਡਣ ਜਾਂਦਾ ਹਾਂ ਪਰ ਮੈਂ ਇਸ ਕੱਪੜਿਆਂ ਵਿੱਚ ਅਰਾਮਦਾਇਕਾ ਨਾਲ ਖੇਡ ਨਹੀਂ ਖੇਡ ਪਾਉਂਦਾ ਤਾਂ ਮੈਂ ਅਕਸਰ ਕ੍ਰਿਕਟ ਆਲੇ ਹੀ ਜੁੱਤੇ ਖਰੀਦਦਾ ਹਾਂ